ਹੈਲੋ ਐਮਾਜੋਨ ਕਸਟਮਰ ਕੇਅਰ ਮੇਰਾ ਨਾਮ ਗੁਰਪ੍ਰੀਤ ਕੌਰ ਹੈ ਮੈਂ ਬਹੁਤ ਜ਼ਿਆਦਾ ਪ੍ਰੋਡਕਟ ਔਨਲਾਈਨ ਮੰਗਵਾਉਂਦੀ ਰਹਿੰਦੀ ਹਾਂ ਹਾਂ ਪਰੰਤੂ ਮੈਂ ਬਹੁਤ ਜ਼ਿਆਦਾ ਤੋਂ ਜ਼ਿਆਦਾਤਰ ਐਮਾਜੋਨ ਐਪ ਦਾ ਹੀ ਵਰਤੋਂ ਕਰਦੀ ਹਾਂ ਕਿਉਂਕਿ ਮੈਨੂੰ ਇਸ ਦਾ ਐਕਸਪੀਰੀਅੰਸ ਬਹੁਤ ਵਧੀਆ ਲੱਗਿਆ ਮੇਰੀ ਐਮਾਜੋਨ ਆਈ ਡੀ ਗੁਰਪ੍ਰੀਤ ਨਾਈਨ ਟੂ ਏਟ ਫਾਈਵ ਸਿਕਸ ਹੈ ਮੈਂ ਹਾਲ ਹੀ ਵਿੱਚ ਇੱਕ ਕਲਰ ਪੈਨਸਲ ਔਡਰ ਕੀਤੀਆਂ ਸਨ ਜਿਹਨਾਂ ਦਾ ਬਰੈਂਡ ਨੇਮ ਓਇਲ ਪੈਸਟਲ ਕਲਰ ਸੀ ਮੈਂ ਜਦੋਂ ਮੈਂ ਇਹ ਪੈਨਸਿਲ ਔਡਰ ਕੀਤੀਆਂ ਸਨ ਤਾਂ ਇਹਨਾਂ ਦੀ ਡਿਲੀਵਰੀ ਚਾਰ ਦਿਨ ਬਾਅਦ ਦੀ ਸੀ ਪਰ ਇਹ ਮੈਨੂੰ ਇਹ ਪੈਨਸਿਲ ਦੋ ਦਿਨ ਵਿੱਚ ਹੀ ਪ੍ਰਾਪਤ ਹੋ ਗਈਆਂ ਇਹਨਾਂ ਦਾ ਪ੍ਰਾ ਪ੍ਰਾਈਜ਼ ਬਹੁਤ ਘੱਟ ਸੀ ਇਹ ਇਸ ਐਮਾਜੋਨ ਉੱਪਰ ਡਿਸਕਾਉਂਟ ਵਿੱਚ ਇਹ ਪੈਨਸਲ ਅਵੇਲੇਬਲ ਸਨ ਪਰ ਜਦੋਂ ਮੈਂ ਮਾਰਕੀਟ ਵਿੱਚ ਇਹਨਾਂ ਲੈਣ ਗਈ ਤਾਂ ਇਨ ਜਦੋਂ ਇਨ ਮੈਂ ਇਹਨਾਂ ਦਾ ਪ੍ਰਾਈਜ਼ ਪੁੱਛਿਆ ਤਾਂ ਉੱਥੇ ਇਹਨਾਂ ਦਾ ਪ੍ਰਾਈਜ਼ ਟੂ ਫਿਫਟੀ ਸੀ ਪਰ ਮੈਨੂੰ ਇਹ ਪੈਨਸਲ ਐਮਾਜੋਨ ਉੱਤੇ ਵਨ ਥਰਟੀ ਵਿੱਚ ਮਿਲ ਗਈਆਂ ਮੈਂ ਇਹਨਾਂ ਨੂੰ ਪਾ ਕੇ ਬਹੁਤ ਜ਼ਿਆਦਾ ਖੁਸ਼ ਸੀ ਜਦੋਂ ਮੈਂ ਇਹ ਪੈਨਸਿਲ ਤੇ ਖੋਲਨ ਦੀ ਪੈਕਿੰਗ ਖੋਲ੍ਹੀ ਇਹਨਾਂ ਦੀ ਪੈਕਿੰਗ ਬਹੁਤ ਜ਼ਿਆਦਾ ਸੋਹਣੀ ਹੋਈ ਸੀ ਜਦੋਂ ਮੈਂ ਇਹ ਪੈਨਸਿਲ ਨੂੰ ਪੇਪਰ ਉੱਪਰ ਚਲਾ ਕੇ ਦੇਖੀਆਂ ਤਾਂ ਇਹ ਬਹੁਤ ਜ਼ਿਆਦਾ ਸਮੂਥਲੀ ਚੱਲਦੀਆਂ ਸਨ ਅਤੇ ਇਹਨਾਂ ਦੀ ਬਲੈਂਡਿੰਗ ਵੀ ਬਹੁਤ ਜ਼ਿਆਦਾ ਚੰਗੀ ਸੀ ਮੈਂ ਇਹਨਾਂ ਨੂੰ ਪਾ ਕੇ ਬਹੁਤ ਜ਼ਿਆਦਾ ਖੁਸ਼ ਹੋਈ ਹੁਣ ਜਦੋਂ ਵੀ ਮੈਂ ਫ੍ਰੀ ਹੁੰਦੀ ਹਾਂ ਜਾਂ ਫਿਰ ਮੈਂ ਥੱਕੀ ਹੋਈ ਹੁੰਦੀ ਹਾਂ ਤਾਂ ਮੈਨੂੰ ਡਰਾਇੰਗ ਕਰਨ ਡਰਾਇੰਗ ਕਰਨ ਦਾ ਜੀਅ ਕਰਦਾ ਹੈ ਕਿਉਂਕਿ ਪੈਨਸਲ ਬਹੁਤ ਜ਼ਿਆਦਾ ਚੰਗੀਆਂ ਹਨ ਮੈਂ ਆਪਣੇ ਦੋਸਤਾਂ ਨੂੰ ਵੀ ਇਹ ਦੱਸਿਆ ਹੈ ਕਿ ਉਹ ਇਹ ਐਮਾਜੋਨ ਤੋਂ ਇਹ ਪੈਨਸਿਲ ਮੰਗਵਾਉਣ ਧੰਨਵਾਦ